ਮੈਂ ਕੁਝ ਦਿਨ ਪਹਿਲਾਂ ਹੀ ਮੈਂ ਆਪਣੇ ਨਵੇਂ ਘਰ ਵਿੱਚ ਸ਼ਿਫਟ ਹੋਇਆ ਹਾਂ ਇਸ ਤੋਂ ਪਹਿਲਾਂ ਮੈਂ ਆਪਣੇ ਮਾਂ ਪਿਓ ਨਾਲ ਉਹਨਾਂ ਦੇ ਘਰ ਵਿੱਚ ਰਹਿੰਦਾ ਸੀ ਪਰ ਹੁਣ ਮੇਰੀ ਪ੍ਰਮੋਸ਼ਨ ਹੋਣ ਕਰਕੇ ਮੈਂ ਆਪਣਾ ਇੱਕ ਅਲਗ ਅਪਾਰਟਮੈਂਟ ਖਰੀਦ ਲਿਆ ਹੈ ਅਤੇ ਉਸ ਵਿੱਚ ਸ਼ਿਫਟ ਵੀ ਹੋ ਗਿਆ ਹਾਂ ਹੁਣ ਸ਼ਿਫਟ ਹੋਣ ਕਰਕੇ ਮੈਨੂੰ ਆਪਣੇ ਆਧਾਰ ਕਾਰਡ ਉੱਤੇ ਦਿੱਤੇ ਪਤੇ ਨੂੰ ਵੀ ਅਪਡੇਟ ਕਰਾਉਣਾ ਪਏਗਾ ਇਹ ਮੇਰੀ ਜ਼ਰੂਰਤ ਹੈ ਕਿਉਂਕਿ ਇੱਕ ਦਿਨ ਪਹਿਲਾਂ ਹੀ ਮੈਂ ਇੱਕ ਚੀਜ਼ ਆਰਡਰ ਕੀਤੀ ਅਤੇ ਅਡੰਟੀ ਵਜੋਂ ਆਪਣਾ ਆਧਾਰ ਕਾਰਡ ਦੇ ਦਿੱਤਾ ਉਹਨਾਂ ਨੂੰ ਜਿਸ ਕਰਕੇ ਮੇਰੇ ਸਮਾਨ ਦੀ ਡਿਲੀਵਰੀ ਮੇਰੇ ਪੁਰਾਣੇ ਪਤੇ 'ਤੇ ਹੋ ਗਈ ਇਸ ਨਾਲ ਮੈਨੂੰ ਅਤੇ ਮੇਰੇ ਮਾਂ ਪਿਓ ਨੂੰ ਬੜੇ ਹੀ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪਿਆ ਹੁਣ ਇਸ ਦਿੱਕਤ ਤੋਂ ਬਚਣ ਲਈ ਹੀ ਮੈਨੂੰ ਆਪਣੇ ਆਧਾਰ ਕਾਰਡ ਦੇ ਪਤੇ ਨੂੰ ਅਪਡੇਟ ਕਰਵਾਉਣਾ ਹੈ ਤਾਂ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਇਸ ਪਤੇ ਨੂੰ ਅਪਡੇਟ ਕਰਨ ਦੀ ਅਰਜ਼ੀ ਵੱਲ ਧਿਆਨ ਦੋ ਅਤੇ ਜਿੰਨਾ ਜਲਦੀ ਹੋ ਸਕੇ ਇਸ ਨੂੰ ਅਪਡੇਟ ਕਰ ਦਿਓ ਤਾਂ ਜੋ ਮੇਰੀ ਮੁਸ਼ਕਿਲਾਂ ਆਸਾਨ ਹੋ ਸਕਣ